ਤੁਸੀਂ ਨਾਗਪਾਲ ਸਟੋਰ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਬਜਾਜ ਆਲਮੰਡਲ ਦਾ ਏਅਰ ਆਈਲ ਖਰੀਦਿਆ ਸੀ ਇਹ ਹੇਅਰ ਆਇਲ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਨੂੰ ਹਫਤਾ ਹੋਇਆ ਹੈ ਇਸ ਨੂੰ ਵਰਤਦਿਆਂ ਇਸ ਤੇਲ ਨਾਲ ਮੈਨੂੰ ਕਾਫੀ ਫਰਕ ਪਿਆ ਪਹਿਲਾਂ ਮੇਰੇ ਵਾਲ ਕਾਫੀ ਝੜਦੇ ਸਨ ਅਤੇ ਨਾ ਹੀ ਵੱਧ ਰਹੇ ਸਨ ਪਰ ਜਦੋਂ ਤੋਂ ਮੈਂ ਇਹ ਤੇਲ ਵਰਤ ਰਹੀ ਹਾਂ ਮੈਨੂੰ ਇਸ ਨਾਲ ਕਾਫੀ ਅਸਰ ਕੀਤਾ ਹੈ ਇਸ ਨਾਲ ਮੇਰੇ ਵਾਲ ਪਹਿਲਾਂ ਨਾਲੋਂ ਕਾਫੀ ਝੜਨੋਂ ਹਟ ਗਏ ਹਨ ਅਤੇ ਨਵੇਂ ਵਾਲਾਂ ਦੀ ਗਰੋਥ ਵੀ ਸ਼ੁਰੂ ਹੋ ਗਈ ਹੈ ਮੈਨੂੰ ਤੁਹਾਡਾ ਇਹ ਪ੍ਰੋਡਕਟ ਬਹੁਤ ਹੀ ਵਧੀਆ ਲੱਗਿਆ ਅਤੇ ਮੈਂ ਤੁਹਾਡੇ ਇਸ ਪ੍ਰੋਡਕਟ ਬਾਰੇ ਆਪਣੇ ਜਾਣਕਾਰਾਂ ਵਿੱਚ ਜ਼ਰੂਰ ਦੱਸਾਂਗੀ ਉਹ ਵੀ ਇਸ ਨੂੰ ਤੁਹਾਡੇ ਤੋਂ ਜ਼ਰੂਰ ਖਰੀਦਣਗੇ